ਅਜਿਹਾ ਵਿਅਕਤੀ ਜੋ ਕਿ ਚਿੱਤਰਕਾਰੀ ਦੇ ਵਿੱਚ ਦਾ ਸ਼ੌਕੀਨ ਹੈ ਚਿੱਤਰਕਾਰੀ ਦੇ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਉਸਨੂੰ ਕਿਸੇ ਵਧੀਆ ਆਰਟ ਕੋਲੇਜ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ ਤਾਂ ਕਿ ਉਹ ਉਥੋਂ ਆਪਣੀ ਚਿੱਤਰਕਾਰੀ ਜਿਹੜੀ ਹੈ ਉਸਨੂੰ ਸੁਧਾਰ ਸਕੇ ਕਿਉਂਕਿ ਇਹ ਹੁਨਰ ਇਸ ਤਰਾਂ ਦਾ ਹੈ ਜਿਸ ਨੂੰ ਕਿ ਸੁਧਾਰਨ ਦੀ ਲੋੜ ਹੈ ਇਸਦੇ ਵਾਸਤੇ ਇੱਕ ਯੋਗ ਵਿਅਕਤੀ ਦੀ ਲੋੜ ਹੈ ਜਿਹੜਾ ਕਿ ਜਿਹੜਾ ਪਰਸਨ ਹੈ ਉਸਨੂੰ ਜਾਂ ਵਿਅਕਤੀ ਹੈ ਉਸਨੂੰ ਚਿੱਤਰਕਾਰੀ ਸਿਖਾ ਸਕੇ